ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾ ਇੱਕ ਨਵਾਂ ਨਵਾਂ ਆਸ਼ੀਰਵਾਦ ਨਾਮ ਦਾ ਇੱਕ ਸਕੂਲ ਖੋਲਿਆ ਹੈ ਅਤੇ ਮੈਨੂੰ ਉਸ ਲਈ ਨਵੀਂ ਬੱਸ ਚਾਹੀਦੀ ਹੈ ਮੈਂ ਨਵੀਂ ਬੱਸ ਤਾਂ ਲੈ ਚੁੱਕੀ ਹਾਂ ਪਰ ਹੁਣ ਮੈਂ ਉਹਨੂੰ ਰਜਿਸਟਰ ਕਰਾਉਣਾ ਚਾਹੁੰਦੀ ਹਾਂ ਅਤੇ ਉਸ ਬਾਰੇ ਮੈਂ ਤੁਹਾਨੂੰ ਕੁਛ ਪੁੱਛਣਾ ਸੀ ਜਿਵੇਂ ਕਿ ਤੁਸੀਂ ਤੁਹਾਨੂੰ ਵੀ ਤੁਸੀਂ ਵੀ ਹੁਣ ਜਿੱਦਾਂ ਨਵਾਂ ਨਵਾਂ ਹੀ ਕੰਮ ਖੋਲਿਆ ਹੈ ਅਤੇ ਨਵਾਂ ਨਵਾਂ ਤੁਸੀਂ ਆਪਣਾ ਵਹੀਕਲ ਜਿਹੜਾ ਏ ਉਹ ਰਜਿਸਟਰ ਕਰਾ ਚੁੱਕੇ ਹੋ ਅਤੇ ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਵੀ ਜਿਹੜਾ ਬੱਸ ਹੈ ਮੇਰੀ ਵੀ ਜਿਹੜੀ ਰਜਿਸਟਰ ਹੋ ਜਾਵੇ ਸੋ ਜਿਸ ਕਾਰਨ ਜਿਹੜਾ ਸਾਡੇ ਬੱਸ ਚਲਾਉਣ ਵਾਲੇ ਕਰਮਚਾਰੀ ਹਨ ਉਹਨਾਂ ਨੂੰ ਕੋਈ ਵੀ ਮੁਸੀਬਤ ਨਾ ਆਵੇ ਅਤੇ ਜਿਹੜੇ ਸਾਡੇ ਬੱਚੇ ਹਨ ਬਸ ਵਿੱਚ ਬੈਠਣ ਵਾਲੇ ਅਤੇ ਉਹਨਾਂ ਨੂੰ ਵੀ ਕੋਈ ਵੀ ਜਿਸ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਜਿਹੜੀ ਉਹਦੀ ਅਰਜ਼ੀ ਹੈ ਉਹਦੇ ਵਿੱਚ ਕੀ ਲਿਖਣਾ ਹੈ ਕਿ ਮੇਰੀ ਬਸ ਜਿਹੜੀ ਹੈ ਉਹ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਰਜਿਸਟਰ ਹੋ ਜਾਵੇ ਅਤੇ ਦੂਜਾ ਮੈਨੂੰ ਇਹ ਪੁੱਛਣਾ ਸੀ ਕਿ ਮੈਨੂੰ ਕਿ ਕਿਰਪਾ ਕਰਕੇ ਸਹਾਇਤਾ ਦੋ ਕੀ ਹਾਂ ਮੈਂ ਉਹਨੂੰ ਵਧੀਆ ਤਰ੍ਹਾਂ ਰਜਿਸਟਰ ਕਰ ਸਕਾਂ ਅਤੇ ਉਹਦੇ ਵਿੱਚ ਆਪਣਾ ਕਿਹੜੀ ਕਿਹੜੀ ਬਸ ਦੀ ਬਸ ਦੇ ਬਾਰੇ ਕੀ ਕੀ ਲਿਖਣਾ ਹੈ ਜਿਵੇਂ ਕਿ ਮੇਰਾ ਬੱਸ ਦਾ ਨੰਬਰ ਹੈ ਪੀਬੀ ਜ਼ੀਰੋ ਨਾਈਨ ਏ ਜੇ ਟੂ ਫਾਈਵ ਨਾਈਨ ਥਰੀ ਮੇਰਾ ਇਹ ਬਸ ਦਾ ਨੰਬਰ ਹੈ ਅਤੇ ਉਹ ਛ ਪੀਲੇ ਰੰਗ ਦੀ ਹੈ ਅਤੇ ਉਹਦੇ 'ਤੇ ਮੇਰੇ ਸਕੂਲ ਦਾ ਨਾਮ ਲਿਖਿਆ ਹੋਇਆ ਹੈ ਰਜਿਸਟਰ ਕਰਾਉਣ ਵਾਸਤੇ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਹੋਰ ਉਹਦੇ ਵਾਸਤੇ ਕੀ ਲਿਖਾਂ ਕਿਉਂਕਿ ਮੈਂ ਇੱਕ ਬਹੁਤ ਠੀਕ ਠੀਕ ਠਾਕ ਫੈਮਲੀ ਠੀਕ ਠਾਕ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਨੂੰ ਨਹੀਂ ਪਤਾ ਮੈਂ ਪਹਿਲੀ ਬੱਸ ਲਿੱਤੀ ਆ ਆਪਣੇ ਬੱਚਿਆਂ ਵਾਸਤੇ ਕਿਉਂਕਿ ਅਜੇ ਮੈਨੂੰ ਸਕੂਲ ਵਿੱਚ ਬੱਚੇ ਘੱਟ ਹਨ ਅਤੇ ਮੈਂ ਆਪਣੇ ਬੱਚੇ ਦੀ ਵਾਸਤੇ ਪਹਿਲੀ ਬੱਸ ਲਿੱਤੀ ਹੈ ਅਤੇ ਮੈਨੂੰ ਇਹ ਦੱਸਿਆ ਦੱਸੋ ਕਿ ਕਿਵੇਂ ਉਹਨੂੰ ਮੈਂ ਰਜਿਸਟਰ ਕਰਾਵਾਂ ਕਿ ਮੇਰੀ ਆਰਾਮ ਨਾਲ ਉਹ ਬਸ ਰਜਿਸਟਰ ਹੋ ਜਾਵੇ ਧੰਨਵਾਦ